ਸਾਡੇ ਦੇਸ਼ ਦੇ ਵਿੱਚ ਲਗਾਤਾਰ ਮਾਰਸ਼ਲ ਆਰਟ ਦੀ ਜਿਹੜੀ ਕਮਿਊਨਿਟੀ ਹੈ ਇਹਦੇ ਵਿੱਚ ਬਹੁਤ ਬਦਲਾਅ ਆਏ ਨੇ ਅਤੇ ਬਹੁਤ ਹੀ ਮਤਲਬ ਕਹਿ ਲਓ ਕਿ ਸਕਾਰਾਤਮਕ ਵਿਕਾਸ ਹੋਇਆ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪਹਿਲਾਂ ਸਮੇਂ ਵਿੱਚ ਸਾਡੇ ਦੇਸ਼ ਦੇ ਵਿੱਚ ਕੁੜੀਆਂ ਨੂੰ ਖੇਡਣ ਤੋਂ ਮਨਾਹੀ ਸੀ ਅਤੇ ਸਪੈਸ਼ਲੀ ਜਿਹੜੇ ਮਾਰਸ਼ਲ ਆਰਟ ਇਵੈਂਟਸ ਨੇ ਇਹਨਾਂ ਦੇ ਵਿੱਚ ਸਾਡੇ ਦੇਸ਼ ਦੀਆਂ ਬੇਟੀਆਂ ਨੂੰ ਘੱਟ ਹੀ ਮੌਕੇ ਦਿੱਤੇ ਜਾਂਦੇ ਸੀ ਕਿ ਉਹ ਹਿੱਸਾ ਲੈਣ ਪਰ ਜਿਵੇਂ ਜਿਵੇਂ ਸਾਡੇ ਦੇਸ਼ ਦੇ ਵਿੱਚ ਕੁਛ ਬੇਟੀਆਂ ਜਾਗੀਆਂ ਕਈਆਂ ਦੇ ਮਾਪਿਆਂ ਨੇ ਬੜਾ ਸਪੋਰਟ ਕੀਤਾ ਇਹਨਾਂ ਵਿੱਚ ਸਾਡੇ ਹਰਿਆਣੇ ਦੀ ਇੱਕ ਫੈਮਲੀ ਫੋਗਾਟ ਫੈਮਲੀ ਵਿੱਚੋਂ ਦੋ ਬੇਟੀਆਂ ਹੋਈਆਂ ਗੀਤਾ ਅਤੇ ਬਬੀਤਾ ਜਿਨ੍ਹਾਂ ਨੇ ਰੈਸਲਿੰਗ ਦੀ ਦੁਨੀਆਂ ਵਿੱਚ ਆਪਣਾ ਇੱਕ ਵੱਖਰਾ ਹੀ ਨਾਮ ਬਣਾਇਆ ਉਹਨਾਂ ਦੇ ਕਰਕੇ ਸਾਰੇ ਦੇਸ਼ ਦੇ ਵਿੱਚ ਵੱਖਰੇ ਵੱਖਰੇ ਲੈਵਲ ਦੇ ਪਲੇਅਰ ਪੈਦਾ ਹੋਣ ਲੱਗ ਪਏ ਅਤੇ ਹਰ ਮਾਂ ਪੇ ਨੇ ਆਪਣੇ ਕੁੜੀਆਂ ਨੂੰ ਇਸ ਗੇਮ ਵਿੱਚ ਪਾਉਣ ਦੀ ਕਹਿ ਲਓ ਕਿ ਸ਼ੁਰੂਆਤ ਕੀਤੀ ਅਤੇ ਅੱਜ ਦੇ ਸਮੇਂ ਵਿੱਚ ਇਹ ਦੇਸ਼ ਮਾਰਸ਼ਲ ਆਰਟ ਦੇ ਵਿੱਚ ਵੀ ਬਹੁਤ ਅੱਛੇ ਨੰਬਰ 'ਚ ਹੈ ਇਸ ਤਰੀਕੇ ਵਰਲਡ ਫੇਮਸ ਸਾਡੀ ਜਿਹੜੀ ਮਾਰਸ਼ਲ ਆਰਟ ਦੀ ਖਿਡਾਰਨ ਹੈ ਮੈਰੀ ਕੋਮ ਉਹਨਾਂ ਦੇ ਕਰਕੇ ਵੀ ਇਹ ਗੇਮ ਬਹੁਤ ਜ਼ਿਆਦਾ ਲੋਕਪ੍ਰਿਯ ਹੁੰਦੀ ਰਹੀ ਹੈ ਆਪਣੇ ਭਾਰਤ ਦੇ ਵਿੱਚ ਅਤੇ ਜੇ ਇਹ ਗੇਮਾਂ ਵਿੱਚ ਆਪਾਂ ਹੋਰ ਸੁਧਾਰ ਕਰਨਾ ਚਾਹੁੰਦੇ ਹਾਂ ਹੋਰ ਵਿਕਸਿਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਕਿ ਆਪਾਂ ਹੋਰ ਵੀ ਕੁਝ ਸੁਝਾਅ ਨੇ ਮੇਰੇ ਇਹਨਾਂ ਨੂੰ ਆਪਾਂ ਥੋੜ੍ਹਾ ਵਰਤੋਂ ਵਿੱਚ ਲੈ ਕੇ ਆਈਏ ਜਿਵੇਂ ਕਿ ਹਰ ਗੇਮ ਲਈ ਖੇਡਣ ਲਈ ਇੱਕ ਕਿਤੇ ਨਾ ਕਿਤੇ ਇੱਕ ਸਹੀ ਤਰੀਕੇ ਦਾ ਗਰਾਊਂਡ ਹੁੰਦਾ ਹੈ ਕੋਈ ਨਾ ਕੋਈ ਸਟੇਡੀਅਮ ਹੁੰਦਾ ਉਸ ਤਰੀਕੇ ਮਾਰਸ਼ਲ ਆਰਟ ਦਾ ਵੀ ਇੱਕ ਗਰਾਊਂਡ ਜਾਂ ਹਰ ਮਾ ਸਟੇਡੀਅਮ ਦੇ ਵਿੱਚ ਮਾਰਸ਼ਲ ਆਰਟ ਲਈ ਇੱਕ ਸਹੀ ਤਰੀਕੇ ਦਾ ਸਹੀ ਲੋੜੀਂਦਾ ਇੱਕ ਹੋਲ ਹੋਣਾ ਜ਼ਰੂਰੀ ਹੈ ਜਿਸ ਦੇ ਵਿੱਚ ਡੇਲੀ ਕੋਚ ਆਉਣ ਉੱਥੇ ਬੱਚੇ ਖੇਡਣ ਅਤੇ ਉਹਨਾਂ ਨੂੰ ਖੇਡਾਂ ਤੋਂ ਬਾਅਦ ਅੱਛੇ ਲੈਵਲ ਦੀ ਇੱਕ ਜੋਬ ਵੀ ਦਿੱਤੀ ਜਾਵੇ ਜਿੱਥੇ ਉਹ ਜਾ ਕੇ ਨੌਕਰੀ ਕਰੇ ਅਤੇ ਆਪਣੇ ਜਿਹੜਾ ਡੇਲੀ ਦਾ ਲਾਈਫ ਹੈ ਉਹਨੂੰ ਇਹ ਜੀਅ ਸਕੇ ਅਤੇ ਸਾਡੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਕਹਿ ਲਓ ਕਿ ਸੁਧਾਰ ਦੀ ਲੋੜ ਹੈ ਉਹ ਇਹ ਹੀ ਆ ਕਿ ਜਿੱਦਾਂ ਸਾਡੇ ਸਪੋਰਟਸ ਮਨਿਸਟਰ ਨੇ ਜਾਂ ਫਿਰ ਕੋਈ ਹੋਰ ਵੀ ਜਿਹੜੇ ਸਪੋਰਟਸ ਨੂੰ ਚਲਾ ਰਿਹਾ ਹੋਵੇ ਜਿਹੜੇ ਗੇਮ ਨੂੰ ਖੇਡ ਰਹੇ ਹੈ ਖਿਡਾ ਰਹੇ ਨੇ ਉਹਨਾਂ ਦੇ ਅੰਦਰ ਇੱਕ ਇਨਸਾਨੀਅਤ ਪੈਦਾ ਕੀਤੀ ਜਾਵੇ ਅਤੇ ਹਮੇਸ਼ਾ ਜਦੋਂ ਵੀ ਗੇਮ ਦੇ ਵਿੱਚ ਖਿਡਾਰੀ ਚੁਣਨੇ ਆ ਉਹਨਾਂ ਨੂੰ ਸਲੈਕਟ ਕਰਨਾ ਹੈ ਅਤੇ ਉਹਨਾਂ ਦੇ ਪਰਫੋਰਮੈਂਸ ਦੇ ਅਕੋਰਡਿੰਗ ਉਹਨਾਂ ਨੂੰ ਸ ਸਲੈਕਟ ਕੀਤਾ ਜਾਵੇ ਨਾ ਕੀ ਆਪਣੇ ਵਾਕਵੀਅਤ ਕਰਕੇ ਅਤੇ ਦੂਜੀ ਗੱਲ ਕਿ ਜੋ ਇਕੁਵਮੈਂਟ ਜੋ ਬੱਚਿਆਂ ਨੂੰ ਖੇਡਣ ਲਈ ਜਾਂ ਖਿਡਾਰੀ ਨੂੰ ਖੇਡਣ ਲਈ ਜਿਹੜੀ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਉਹ ਪ੍ਰੋਪਰ ਸਹੀ ਤਰੀਕੇ ਨਾਲ ਉਹ ਦਿੱਤੇ ਜਾਣ ਜਿਹਦੇ ਕਰਕੇ ਇੱਕ ਅੱਛੇ ਲੈਵਲ ਦਾ ਖਿਡਾਰੀ ਤਿਆਰ ਹੋ ਸਕੇ